ਪੰਜਾਬ ਵਿੱਚ ਵੱਖ ਵੱਖ ਸਮੇਂ 'ਤੇ ਵੱਖ ਵੱਖ ਸਰਕਾਰਾਂ ਆਈਆਂ ਹਨ ਅਕਾਲੀ ਦਲ ਬਾਦਲ ਅਤੇ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਕਾਫ਼ੀ ਸਮਾਂ ਰਾਜ ਕੀਤਾ ਕਈ ਚੀਜ਼ਾਂ ਦਾ ਸੁਧਾਰ ਉਨ੍ਹਾਂ ਨੇ ਕੀਤਾ ਬੱਚਿਆਂ ਨੂੰ ਆ ਕਈਆਂ ਗਰੀਬਾਂ ਨੂੰ ਮੁਫ਼ ਮੁਫ਼ਤ ਰਾਸ਼ਨ ਦਿੱਤਾ ਗਿਆ ਪੜ੍ਹਨ ਵਾਲੀ ਕੁੜੀਆਂ ਨੂੰ ਸਾਈਕਲਾਂ ਵੰਡ ਦੀ ਜੋ ਸਕੀਮ ਸੀ ਉਹ ਅਕਾਲੀ ਦਲ ਸਰਕਾਰ ਵਲੋਂ ਹੀ ਚਲਾਈ ਗਈ ਉਨ੍ਹਾਂ ਨੇ ਹੁਣ ਬੀਜ਼ੇਪੀ ਅਤੇ ਅਕਾਲੀ ਦਲ ਦਾ ਗਠਬੰਧਨ ਹੈ ਪਹਿਲਾਂ ਉਨ੍ਹਾਂ ਨੇ ਕਾਫ਼ੀ ਦੇਰ ਪੰਦਰ੍ਹਾਂ ਸਾਲ ਵੀ ਲਗਾਤਾਰ ਰਾਜ ਕੀਤਾ ਕਦੇ ਕੋਂਗਰਸ ਵੀ ਆਈ ਕੋਂਗਰਸ ਲੀਡਰਾਂ ਨੇ ਵੀ ਆਪਣਾ ਬੜਾ ਅੱਛਾ ਕੰਮ ਕੀਤਾ ਉਨ੍ਹਾਂ ਨੇ ਵੀ ਸਰਕਾਰੀ ਨੌਕਰੀਆਂ ਕਈ ਲੋਕਾਂ ਨੂੰ ਦਿੱਤੀਆਂ ਜਿਹਦੇ ਵਿੱਚ ਕੋਈ ਰਿਸ਼ਵਤ ਨਹੀਂ ਲਿੱਤੀ ਗਈ ਲੋਕਾਂ ਦੇ ਬਿੱਲ ਮਾਫ਼ ਕੀਤੇ ਗਏ ਗਰੀਬ ਲੋਕ ਜਿਹੜੇ ਕਈ ਦੇਰ ਤੋਂ ਬਿਜਲੀ ਦੇ ਬਿੱਲ ਦੇ ਨਹੀਂ ਸਕਦੇ ਸਨ ਉਨ੍ਹਾਂ ਦੇ ਬਿੱਲ ਵੀ ਮਾਫ਼ ਕੀਤੇ ਗਏ ਸਮੇਂ ਸਮੇਂ 'ਤੇ ਜਿਹੜੀ ਵੀ ਸਰਕਾਰ ਆਈ ਹਰ ਸਰਕਾਰ ਆਪਣਾ ਆਪਣਾ ਯਤਨ ਕਰਦੀ ਹੈਗੀ ਹੈ ਆਪਣੀ ਸਟੇਟ ਨੂੰ ਸਟੇਟ ਦਾ ਸੁਧਾਰ ਕੀਤਾ ਜਾਵੇ ਲੇਕਿਨ ਹਰ ਇੱਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਕੋਈ ਕਿਸੇ ਨੂੰ ਪਸੰਦ ਕਰਦਾ ਹੈ ਕੋਈ ਕਿਸੇ ਨੂੰ ਪਸੰਦ ਕਰਦਾ ਹੈ ਲੇਕਿਨ ਦੇਖੋ ਸਰਕਾਰ ਜੋ ਹੈ ਉਹ ਤਾਂ ਸਰਕਾਰਾਂ ਨੇ ਹੀ ਚਲਾਉਣੀ ਹੈ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਹਰ ਬੰਦਾ ਇੱਕ ਚੇਂਜ ਚਾਂਦਾ ਹੈ ਇਸ ਲਈ ਪੰਜ ਸਾਲ ਇੱਕ ਇੱਕ ਸਰਕਾਰ ਰਾਜ ਕਰਦੀ ਹੈ ਫੇਰ ਉਸ ਤੋਂ ਬਾਅਦ ਦੂਸਰੀ ਆਉਂਦੀ ਹੈ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਤਾਂ ਪੰਦਰਾਂ ਸਾਲ ਲਗਾਤਾਰ ਰਾਜ ਕੀਤਾ ਕਈ ਕੰਮ ਚੰਗੇ ਹੁੰਦੇ ਹਨ ਜਿਨ੍ਹਾਂ ਦੇ ਕਰਕੇ ਉਹ ਸਰਕਾਰ ਦੁਆਰਾ ਡਿੱਗਦੀ ਰਹਿੰਦੀ ਹੈ ਲੋਕਤੰਤਰ ਦੀ ਸਰਕਾਰ ਹੈ ਲੋਕਾਂ ਨੂੰ ਹੱਕ ਹੈ ਕੀ ਉਹ ਆਪਣੀ ਮਨਪਸੰਦ ਸਰਕਾਰ ਚੁਣ ਸਕਦੇ ਹਨ ਇਸ ਕਰਕੇ ਸਾਰੇ ਆਪਣੇ ਆਪਣੇ ਮਨਪਸੰਦ ਸਰਕਾਰ ਚੁਣਦੇ ਹਨ ਧੰਨਵਾਦ